ਹਾਂਜੀ ਭੰਗੜਾ ਐਰੋਬਿਕਸ ਜਿਹੜੀ ਗਤੀਵਿਧੀ ਦੇ ਤੌਰ 'ਤੇ ਬਹੁਤ ਵਧੀਆ ਕਸਰਤ ਹੈ ਇਸ ਨੂੰ ਕਰਨ ਨਾਲ ਸਾਡਾ ਸਰੀਰ ਵੀ ਹਲਕਾ ਰਹਿੰਦਾ ਹੈ ਅਤੇ ਸਾਡੇ ਸਰੀਰ ਤੰਦਰੁਸਤ ਵੀ ਹੋ ਜਾਂਦਾ ਹੈ ਭੰਗੜਾ ਇੱਕ ਬਹੁਤ ਵਧੀਆ ਕਸਰਤ ਹੈ ਜੋ ਸਾਡੇ ਆਪਣੇ ਸਰੀਰ ਵਿੱਚ ਰੋਜ਼ ਹੀ ਸ਼ਾਮਲ ਕਰਨਾ ਚਾਹੀਦਾ ਹੈ ਇਹ ਇੱਕ ਬਹੁਤ ਵਧੀਆ ਐਰੋਬਿਕਸ ਦਾ ਕੰਮ ਵੀ ਕਰਦਾ ਹੈ ਭੰਗੜਾ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਸਾਡਾ ਸਰੀਰ ਹਲਕਾ ਅਤੇ ਤੰਦਰੁਸਤ ਹੋ ਜਾਂਦਾ ਹੈ ਅੱਜ ਕੱਲ੍ਹ ਬੱਚੇ ਨੌਜਵਾਨ ਬੁੱਢੇ ਸਭ ਇਸ ਵੱਲ ਤੁਰੇ ਜਾਂਦੇ ਹਨ ਸਰੀਰਿਕ ਗਤੀਵਿਧੀ ਵਧੀਆ ਕਰਦੇ ਹਨ ਜੋ ਕਿ ਭੰਗੜਾ ਇਸ ਦੇ ਲਈ ਸਭ ਤੋਂ ਵਧੀਆ ਕਸਰਤ ਹੈ ਸਾਡੇ ਘਰ ਦੇ ਸਾਹਮਣੇ ਪਾਰਕ ਵਿੱਚ ਵੀ ਬਹੁਤ ਵਧੀਆ ਭੰਗੜਾ ਕਰਵਾਇਆ ਜਾਂਦਾ ਹੈ ਜਿਸ ਨਾਲ ਮੇਰਾ ਸਰੀਰ ਦੇ ਔਰ ਵਧੀਆ ਹੋ ਗਿਆ ਹੈ ਕਰਨ ਦੇ ਨਾਲ ਭੰਗੜਾ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਹੋਣ ਦੇ ਨਾਲ ਨਾਲ ਫੁਰਤੀਲਾ ਵੀ ਹੋ ਜਾਂਦਾ ਹੈ ਅਤੇ ਸਿਹਤਮੰਦ ਵੀ ਰਹਿੰਦਾ ਹੈ ਭੰਗੜਾ ਇੱਕ ਤਰ੍ਹਾਂ ਦੀ ਕਸਰਤ ਹੀ ਮੰਨੀ ਜਾਂਦੀ ਹੈ ਜਿਸ ਤਰ੍ਹਾਂ ਕਸਰਤ ਕਰਨ ਨਾਲ ਸਰੀਰ ਤੰਦਰੁਸਤ ਅਤੇ ਫੁਰਤੀਲਾ ਰਹਿੰਦਾ ਹੈ ਉਸ ਤਰ੍ਹਾਂ ਭੰਗੜਾ ਕਰਨ ਨਾਲ ਵੀ ਸਰੀਰ ਤੰਦਰੁਸਤ ਅਤੇ ਫੁਰਤੀਲਾ ਰਹਿੰਦਾ ਹੈ ਇਸ ਕਰਕੇ ਸਾਨੂੰ ਭੰਗੜਾ ਆਪਣੇ ਜੀਵਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਹੋਰ ਵੀ ਆਪਣੇ ਆਸ ਪਾਸ ਦੇ ਲੋਕਾਂ ਨੂੰ ਐਰੋਬਿਕਸ ਦੇ ਤੌਰ 'ਤੇ ਭੰਗੜਾ ਕਰਨ ਲਈ ਕਹਿਣਾ ਚਾਹੀਦਾ ਹੈ ਭੰਗੜਾ ਇੱਕ ਬਹੁਤ ਵਧੀਆ ਐਰੋਬਿਕਸ ਦਾ ਕੰਮ ਕਰਦਾ ਹੈ ਜਿਸ ਨਾਲ ਸਾਡੇ ਸਰੀਰਿਕ ਗਤੀਵਿਧੀ ਬਹੁਤ ਵਧੀਆ ਹੋ ਜਾਂਦੀ ਹੈ ਔਰ ਇੱਕ ਬਹੁਤ ਵਧੀਆ ਕਸਰਤ ਦਾ ਕੰਮ ਵੀ ਕਰਦੀ ਹੈ ਇਸ ਕਰਕੇ ਭੰਗੜੇ ਨੂੰ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਧੰਨਵਾਦ